ਵੀਹ ਜਨਵਰੀ ਦੋ ਹਜ਼ਾਰ ਚਾਰ ਅਗਸਤ ਉੱਨੀ ਸੌ ਨੜ੍ਹਿਨਵੇਂ ਵੀਹ ਅਪ੍ਰੈਲ ਦੋ ਹਜ਼ਾਰ ਇੱਕ ਚੌਵੀ ਅਪ੍ਰੈਲ ਦੋ ਹਜ਼ਾਰ ਇੱਕੀ ਗਿਆਰ੍ਹਾਂ ਨਵੰਬਰ ਦੋ ਹਜ਼ਾਰ ਦੋ